ਰਾਮ ਮੇਰਾ ਮਿੱਤਰ ਹੈ ਉਸ ਦਾ ਜਨਮ ਉੱਨੀ ਅਪ੍ਰੈਲ ਦੋ ਹਜ਼ਾਰ ਚੌਵੀ ਨੂੰ ਸੀ ਅਤੇ ਮੈਂ ਉਸ ਲਈ ਐਮਾਜੋਨ 'ਤੇ ਇੱਕ ਆਰਡਰ ਬੁੱਕ ਕੀਤਾ ਹੈ ਜੋ ਕਿ ਮੈਂ ਆਪਣੇ ਮਿੱਤਰ ਨੂੰ ਇੱਕ ਗਿਫਟ ਦੇਣਾ ਸੀ ਉਹ ਗਿਫਟ ਸਮਾਰਟ ਵਾਚ ਹੈ ਅਤੇ ਮੈਂ ਇਸ ਇਹ ਅਗਸਤ ਪੰਦ ਆਰਡਰ ਪੰਦਰਾਂ ਅਪ੍ਰੈਲ ਉੱਨੀ ਪੰਦਰਾਂ ਅਪ੍ਰੈਲ ਨੂੰ ਦੋ ਹਜ਼ਾਰ ਚੌਵੀ ਨੂੰ ਕੀਤਾ ਹੈ ਇਹ ਆਰਡਰ ਸਤਾਰ੍ਹਾਂ ਨੂੰ ਅਪ੍ਰੈਲ ਨੂੰ ਮੇਰੇ ਪਾਸ ਆਉਣਾ ਸੀ ਪਰ ਮੇਰੇ ਕੋਲ ਨਹੀਂ ਪਹੁੰਚਿਆ ਅਤੇ ਮੈਂ ਐਮਾਜੋਨ ਕੋਂਪਨੀ 'ਤੇ ਸ਼ਿਕਾਇਤ ਕਰਾ ਕਰਨਾ ਦਰਜ ਕਰਨਾ ਚਾਹੁੰਦਾ ਹਾਂ ਕਿ ਵੀ ਮੇਰੇ ਦੋਸਤ ਦੇ ਜਨਮ ਦਿਨ 'ਤੇ ਮੇਰੇ ਕੋਲੋਂ ਸਹੀ ਟੈਮ 'ਤੇ ਤੁਹਾਡਾ ਸੈਡ ਤੋਂ ਆਰਡਰ ਨਹੀਂ ਪਹੁੰਚਿਆ ਜਿਸ ਕਾਰਨ ਮੇਰੇ ਮਿੱਤਰ ਨੂੰ ਮੈਂ ਗਿਫਟ ਦੇਣ ਤੋਂ ਵਾਂਝਾ ਰਹਿ ਗਿਆ ਕਈ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਮੈਂ ਆਪਣੇ ਮਿੱਤਰ ਨੂੰ ਖੁਸ਼ ਦਿਲੀ ਉਸ ਦੇ ਜਨਮਦਿਨ ਦੀ ਮੁਬਾਰਕ ਨਾ ਦੇ ਸਕਾ ਤਾਂ ਕਿ ਮੈਨੂੰ ਇੱਕ ਬੇਸ਼ਰਮੀ ਇੱਕ ਮੈਂ ਅਹਿਮਤਾ ਦੀ ਸਾਹਮਣਾ ਕਰਨਾ ਪਿਆ ਮੇਰੇ ਦੋਸਤ ਮੇਰਾ ਹੀ ਸਭ ਕੁਛ ਦੁੱਖ ਸੁੱਖ ਦੇਖਣ ਵਾਲਾ ਉਹੀ ਇੱਕ ਰਾਮ ਮੇਰਾ ਮਿੱਤਰ ਸੀ ਜਿਸ ਕਰਕੇ ਮੈਨੂੰ ਉਸ ਦੇ ਜਨਮ ਦਿਨ 'ਤੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਅਤੇ ਉਸ ਦੇ ਜਨਮ ਦਿਨ 'ਤੇ ਮੈਂ ਕੁਛ ਵੀ ਗਿਫਟ ਨਾ ਦੇ ਸਕਾ ਇੱਕ ਤੁਹਾਡੇ ਕੋਂਪਨੀ ਦੇ ਆਰਡਰ 'ਤੇ ਹੀ ਮੈਨੂੰ ਆਸ ਸੀ ਵੀ ਚੱਲ ਮੈਂ ਇੱਕ ਆਪਣੇ ਦੋਸਤ ਨੂੰ ਉਸ ਦੇ ਗੇ ਉੱਤੇ ਜਨਮ ਦਿਨ 'ਤੇ ਮੈਂ ਇੱਕ ਵਧੀਆ ਗਿਫਟ ਦੇ ਸਕਾਂ ਬਟ ਤੁਹਾਡੀ ਕਈ ਨਾਕਾਮੀ ਆਰਡਰ ਕਰਕੇ ਸਥਿਤੀਆਂ ਕਰਕੇ ਮੈਂ ਆਪਣੇ ਦੋਸਤ ਨੂੰ ਇੱਕ ਚੰਗਾ ਗਿਫਟ ਨਹੀਂ ਦੇ ਸਕਿਆ ਅਤੇ ਮੇਰੀ ਇਸ ਸ਼ਿਕਾਇਤ ਨੂੰ ਤੁਸੀਂ ਦਰਜ਼ ਕਰਨਾ ਲਈ ਮੇਰੀ ਹੈਲਪ ਕਰੋ ਅਤੇ ਇਸ ਡਿਲੀਵਰੀ ਨੂੰ ਜਲਦੀ ਤੋਂ ਜਲਦੀ ਮੇਰੇ ਪਾਸ ਭੇਜੋ ਤਾਂ ਕਿ ਮੈਂ ਆਪਦੇ ਦੋਸਤ ਨੂੰ ਇੱਕ ਅੱਛਾ ਗਿਫਟ ਦੇ ਸਕਾਂ ਅਤੇ ਉਸ ਨੂੰ ਖੁਸ਼ ਕਰ ਸਕਾਂ ਉਸ ਦੇ ਮਨ ਦੇ ਵਿੱਚ ਵੀ ਮੇਰੇ ਪ੍ਰਤੀ ਬਹੁਤ ਜ਼ਿਆਦਾ ਰਿਸਪੈਕਟ ਹੈ ਉਸ ਨੂੰ ਮੇਰੇ 'ਤੇ ਬਹੁਤ ਜ਼ਿਆਦਾ ਆਸਾਂ ਨੇਗੀਆਂ ਵੀ ਮੇਰੇ ਜਨਮਦਿਨ ਦੀ ਖੁਸ਼ੀ ਮੇਰੇ ਦੋਸਤ ਰਵਿੰਦਰ ਸਿੰਘ ਨੂੰ ਵੀ ਸਭ ਤੋਂ ਵੱਧ ਹੈ ਉਹ ਹੈ ਵੀ ਸੱਚ ਮੈਨੂੰ ਬਹੁਤ ਖੁਸ਼ੀ ਹੈ ਮੇਰੇ ਦੋਸਤ ਦੇ ਜਨਮਦਿਨ ਤੀ ਲੱਖ ਲੱਖ ਵਧਾਈ ਮੇਰੇ ਦੋਸਤ